ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਨਾ ਤੁਹਾਡਾ ਨੰਬਰ ਲਿਆ ਆਪਾਂ ਘੁੰਮਣ ਆਏ ਹਾਂ ਅਤੇ ਤੁਸੀਂ ਇੱਥੋਂ ਦੇ ਲੋਕਲ ਰਹਿਣ ਵਾਲੇ ਹੋ ਅੱਛਾ ਮੈਮ ਤੁਹਾਡੇ ਤੋਂ ਥੋੜ੍ਹੀ ਇਨਫੋਰਮੇਸ਼ਨ ਚਾਹੀਦੀ ਸੀਗੀ ਮੈਮ ਇੱਥੇ ਦਾ ਰੈਸਟੋਰੈਂਟ ਵਗੈਰਾ ਕਿਹੜੇ ਵਧੀਆ ਨੇ ਅੱਛਾ ਇਹਨਾਂ ਦਾ ਖਾਣ ਪੀਣ ਕਿੱਦਾਂ ਇਹਨਾਂ ਸਾਰਿਆਂ ਵਿੱਚੋਂ ਬੈਸਟ ਰੈਸਟੋਰੈਂਟ ਕਿਹੜਾ ਹੈ

ਖਾਣ ਪੀਣ ਦਾ ਪਾ ਕੇ ਰੂਮ ਦਾ ਵਗੈਰਾ ਸਾਰਾ ਖਰਚਾ ਪਾ ਕੇ ਕਿੰਨਾ ਪ੍ਰਾਈਜ਼ ਆਪਾਂ ਇੱਥੇ ਰਹਿਣ ਵਾਸਤੇ ਖਾਣ ਪੀਣ ਵਾਸਤੇ ਪੂਰਾ ਖਰਚਾ ਕਿੰਨਾ ਹੋ ਜਾਏਗਾ ਇੱਥੇ ਅੱਛਾ ਲੋਕਲ ਮਤਲਬ ਕਿ ਖਾਣ ਪੀਣ ਕਿੰਨੇ ਦਾ ਰੂਮ ਦਾ ਅੱਛਾ ਮਤਲਬ ਕਿ ਜੇ ਆਪਾਂ ਔਰ ਇਥੇ ਮਤਲਬ ਘੁੰਮਣ ਵਾਲੀ ਜਗ੍ਹਾ ਕਿਹੜੀਆਂ ਕਿਹੜੀਆਂ ਆ ਅੱਛਾ ਅੱਛਾ ਮਤਲਬ ਕਿ ਕਰਨ 'ਤੇ ਕੋਈ ਪ੍ਰੋਬਲਮ ਵਗੈਰਾ ਤਾ ਨਹੀਂ ਆਏਗੀ ਜੇ ਗੱਡੀ ਵਗੈਰਾ ਅੱਛਾ ਤਾਂ ਬੁਕਿੰਗ ਕਰਵਾਉਣੀ ਹੋਏ ਤਾਂ ਵੀ ਮਿਲ ਜਾਵੇਗੀ ਤੁਸੀਂ ਆਹ ਨੰਬਰ ਵਗੈਰਾ ਦੇ ਸਕਦੇ ਮਤਲਬ ਦੀ ਚਲੋ ਠੀਕ ਆ ਮੈਮ ਠੀਕ